ਔਨਲਾਈਨ ਸ਼ੋਪਿੰਗ ਵਿੱਚ ਖਰੀਦਦਾਰ ਨੂੰ ਘਰ ਬੈਠੇ ਆਪਣਾ ਸਮਾਨ ਸਮੇਂ ਸਿਰ ਪਹੁੰਚ ਜਾਂਦਾ ਹੈ ਖਰੀਦਦਾਰ ਆਪਣੇ ਮੋਬਾਈਲ ਰਾਹੀਂ ਆਪਣੀ ਅ ਪਸੰਦ ਦੀ ਚੀਜ਼ ਓਡਰ ਕਰਕੇ ਆਪਣੀ ਪਤੇ ਅਨੁਸਾਰ ਆਪਣੀ ਜਗ੍ਹਾ 'ਤੇ ਡਿਲਿਵਰ ਕਰਵਾ ਲੈਂਦਾ ਹੈ ਔਨਲਾਈਨ ਵਿੱਚ ਮੈਂ ਦੋ ਪਲੈਟਫੋਮ ਨੂੰ ਦਿੰਦਾ ਹਾਂ ਪਹਿਲੇ ਨੰਬਰ 'ਤੇ ਹੈਗਾ ਗਾ ਫਲਿਪਕਾਰਟ ਦੂਸਰੇ ਨੰਬਰ 'ਤੇ ਹੈਗਾ ਐਮਾਜ਼ੋਨ ਵੈਸੇ ਤਾਂ ਔਨਲਾਈਨ ਖਰੀਦਦਾਰੀ ਦੇ ਬਹੁਤ ਜ਼ਿਆਦਾ ਸਾਧਨ ਨੇ ਪਰ ਮੈਂ ਇਨ੍ਹਾਂ ਦੋਨਾਂ ਨੂੰ ਜ਼ਿਆਦਾ ਪ੍ਰੈਫਰੇਂਸ ਦਿੰਦਾ ਹਾਂ ਇਨ੍ਹਾਂ ਰਾਹੀਂ ਕੀ ਕਹਿੰਦੇ ਨੇ ਲੋਕਾਂ ਦੇ ਵਿੱਚ ਲੋਕਾਂ ਦਾ ਸਮਾਨ ਜਲਦੀ ਅਪ ਉਨ੍ਹਾਂ ਦੇ ਸਮੇਂ ਸਿਰ ਟਾਈਮ 'ਤੇ ਪਹੁੰਚ ਜਾਂਦਾ ਹੈ ਬਜ਼ਾਰਾਂ ਵਿੱਚ ਔਨਲਾਈਨ ਦੇ ਆਉਣ ਨਾਲ ਬਹੁਤ ਜ਼ਿਆਦਾ ਵਪਾਰੀਆਂ ਨੂੰ ਲੋਸ ਹੋ ਰਿਹਾ ਹੈ ਕਿਉਂਕੀ ਅੱਜ ਕੱਲ੍ਹ ਬਜ਼ਾਰਾਂ ਦੇ ਰੇਟਾਂ ਨਾਲ ਔਨਲਾਈਨ ਦੇ ਰੇਟ ਬਹੁਤ ਜ਼ਿਆਦਾ ਘੱਟ ਹਨ ਜੀ ਐੱਸ ਟੀ ਵੀ ਬਹੁਤ ਜ਼ਿਆਦਾ ਘੱਟ ਲੱਗਦਾ ਹੈ ਅਤੇ ਡਿਲਿਵਰੀ ਚਾਰਜ ਵੀ ਬਹੁਤ ਜ਼ਿਆਦਾ ਮਾਈਨਰ ਹੁੰਦਾ ਹੈ ਔਨਲਾਈਨ ਦੀ ਜਿੱਥੇ ਚੰਗੀਆਂ ਗੱਲਾਂ ਨੇ ਉੱਥੇ ਉਨ੍ਹਾਂ ਦੀਆਂ ਬੁਰੀਆਂ ਗੱਲਾਂ ਵੀ ਹਨ ਚੰਗੀਆਂ ਗੱਲਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਵੀ ਆਪਾਂ ਨੂੰ ਘਰ ਬੈਠੇ ਹੀ ਉਹ ਸਮਾਨ ਡਿਲਿਵਰ ਹੋ ਜਾਂਦਾ ਹੈ ਸਸਤੇ ਰੇਟਾਂ 'ਤੇ ਮਿਲਦਾ ਗਾ ਠੀਕ ਹੈ ਜੀ ਐੱਸ ਟੀ ਘੱਟ ਤੋਂ ਘੱਟ ਲੱਗਦਾ ਉਹ ਹੀ ਵਪਾਰੀ ਕੋਲ ਜਦੋਂ ਆਪਾਂ ਦੁਕਾਨ 'ਤੇ ਜਾਂਦੇ ਹਾਂ ਉਹ ਹੀ ਸਮਾਨ ਆਪਾਂ ਨੂੰ ਮਹਿੰਗੇ ਰੇਟਾਂ 'ਤੇ ਮਿਲਦਾ ਹੈਗਾ ਠੀਕ ਹੈ ਇਹਦੇ ਵਿੱਚ ਬੁਰੀਆਂ ਗੱਲਾਂ ਇਹ ਵੀ ਨੇ ਕਿ ਕਈ ਵਾਰ ਔਨਲਾਈਨ ਮਾਧਿਅਮ ਨਾਲ ਜੋ ਵੀ ਕੰਪਨੀ ਵਾਲੇ ਹੁੰਦੇ ਨੇ ਗੇ ਕਈ ਵਾਰ ਕਰੈਕ ਪੀਸ ਪਾ ਦਿੰਦੇ ਨੇ ਗੇ ਕਈ ਵਾਰ ਕੀ ਕਹਿੰਦੇ ਡਿਫੋਲਟ ਪੀਸ ਪਾ ਦਿੰਦੇ ਨੇ ਫੇਰ ਜਦੋਂ ਆਪਾਂ ਉਨ੍ਹਾਂ ਫੀ ਕੰਪਲੇਂਟ ਪਾ ਦਿੰਦੇ ਕੰਪਲੇਨ ਸੁਣਦੇ ਨਹੀਂ ਹੈਗੇ ਆਪਣਾ ਰਿਫੰਡ ਬਹੁਤ ਜ਼ਿਆਦਾ ਲੇਟ ਹੁੰਦਾ ਗਾ ਇਹ ਇਨ੍ਹਾਂ ਦੀ ਬੁਰੀ ਆਦਤਾਂ ਹੋਗੀਆਂ ਠੀਕ ਹੈ ਇਹਦੇ ਐਡਵਾਂਟੇਜ ਵੀ ਨੇ ਡਿਸਐਡਵਾਂਟੇਜ ਵੀ ਜਿੱਥੇ ਚੰਗੀਆਂ ਗੱਲਾਂ ਨੇ ਉੱਥੇ ਉਹਦੀਆਂ ਬੁਰੀਆਂ ਗੱਲਾਂ ਵੀ ਨੇ ਚੰਗੀਆਂ ਗੱਲਾਂ ਤਾਂ ਦੱਸ ਤਾ ਵੀ ਆਪਣਾ ਸਮੇਂ ਸਿਰ ਸਮਾਨ ਪਹੁੰਚਦਾ ਵਪਾਰੀਆਂ ਨਾਲੋਂ ਆਪਾਂ ਨੂੰ ਘੱਟ ਰੇਟ 'ਤੇ ਸਮਾਨ ਮਿਲਦਾ ਬੁਰੀਆਂ ਗੱਲਾਂ ਇਹ ਨੇ ਕਈ ਵਾਰ ਡਿਫੋਲਟ ਪੀਸ ਆ ਜਾਏ ਉਨ੍ਹਾਂ ਨੂੰ ਰਿਪਲੇਸ ਕਰਨ ਲਈ ਟਾਈਮ ਲੱਗ ਜਾਂਦਾ ਆਪਣੀ ਮਨੀ ਰਿਸੀਵ ਕਰਨ 'ਚ ਟਾਈਮ ਲੱਗ ਜਾਂਦਾ ਗਾ ਠੀਕ ਹੈ ਚੰਗੀਆਂ ਗੱਲਾਂ 'ਚ ਇਹ ਵੀ ਐਡ ਹੋ ਜਾਂਦਾ ਜਦੋਂ ਕੋਈ ਵੀ ਕੈਸ਼ ਰਾਹੀਂ ਦਿੰਦਾ ਹੈ ਜਾਂ ਕੋਈ ਔਨਲਾਈਨ ਪੇਮੈਂਟ ਕਰਦਾ ਉਹਨੂੰ ਕੈਸ਼ਬੈਕ ਆ ਜਾਂਦਾ ਗਾ ਠੀਕ ਹੈ ਉਹਦੇ ਨਾਲ ਉਹਨੂੰ ਥੋੜ੍ਹਾ ਜਹਾ ਬੈਨੀਫਿਟ ਮਿਲ ਜਾਂਦਾ ਗਾ ਠੀਕ ਹੈ ਸਾਰੀਆਂ ਮੇਨ ਗੱਲਾਂ ਤਾਂ ਇਹ ਹੀ ਨੇ ਔਨਲਾਈਨ ਦੇ ਆਉਣ ਨਾਲ ਵਪਾਰਕਾਂ ਦੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਅੱਜ ਕੱਲ੍ਹ ਹਰ ਚੀਜ਼ ਔਨਲਾਈਨ ਆਪਾਂ ਖਰੀਦ ਸਕਦੇ ਹਾਂ ਜਿਵੇਂ ਕਿ ਬੁੱਕਸ ਪੈਨ ਪੈਨਸਲ ਕੋਈ ਵੀ ਹੋਰ ਮੀਨਿੰਗ ਕਲੋਥਸ ਆਪਾਂ ਖਰੀਦ ਸਕਦੇ ਹਾਂ ਕੋਈ ਵੀ ਡਿਵਾਈਸ ਖਰੀਦ ਸਕਦੇ ਹਾਂ ਕੁਛ ਵੀ ਫੈਨ ਰੈਫਰੀਜੇਟਰ ਏਅਰ ਫਰੈਸ਼ਨਰ ਕੁਛ ਵੀ ਐਕਸੈਟਰਾ ਐਨੀਥਿੰਗ